ਅਸੀਂ ਆਪਣੇ ਖੇਤਰ ਦੀ ਗੱਲ ਕਰੀਏ ਤਾਂ ਸਾਡੇ ਖੇਤਰ ਵਿੱਚ ਇਹੋ ਜਿਹੇ ਛੂਤ ਦੀ ਬਿਮਾਰੀ ਜਾਂ ਗੈਰ ਸੰਚਾਲਕ ਬਿਮਾਰੀਆਂ ਬਹੁਤ ਹੀ ਘੱਟ ਹਨ ਜ਼ਿਆਦਾਤਰ ਤਾਂ ਇਹ ਨੋਰਮਲ ਬਿਮਾਰੀਆਂ ਜਿਵੇਂ ਕਿ ਅ ਗਲ੍ਹੇ ਦਾ ਦਰਦ ਨੋਰਮਲ ਬੁਖਾਰ ਆਦਿ ਹੀ ਚੱਲਦਾ ਹੈ ਬਹੁਤ ਹੀ ਘੱਟ ਹੈ ਜੋ ਕਿ ਇੱਥੇ ਬ ਇਹ ਛੂਤ ਦੀਆਂ ਬਿਮਾਰੀਆਂ ਹਨ ਇੱਥੇ ਸਾਡੇ ਬਹੁ ਹੋਸਪੀਟਲ ਹੈ ਸਰਕਾਰੀ ਹੋਸਪੀਟਲ ਹੈ ਬਲਜਿੰਦਰਾਂ ਹੋਸਪੀਟਲ ਹੈ ਪਰਮਾਰ ਹੋਸਪੀਟਲ ਹੈ ਸਾਂਘਾ ਹੋਸਪੀਟਲ ਹੈ ਅਗਰ ਕੋਈ ਇਹੋ ਜਿਹੀ ਕੋਈ ਪਰੋਬਲਮ ਆਉਂਦੀ ਹੈ ਤਾਂ ਉੱਥੇ ਜਾ ਕੇ ਅਸੀਂ ਇਲਾਜ ਕਰਾਉਂਦੇ ਹਾਂ ਵੈਸੇ ਬਹੁਤ ਹੀ ਘੱਟ ਹੈ ਕਿ ਸੌ ਵਿੱਚੋ ਦੋ ਚਾਰ ਪਰਸੈਂਟ ਹੀ ਇਹ ਬਿਮਾਰੀਆਂ ਹਨ ਜੇ ਜੋ ਇੱਥੇ ਸਾਡੇ ਖੇਤਰ ਵਿੱਚ ਹਨ ਤੋਂ ਜਿਹਨਾਂ ਦਾ ਇੱਥੇ ਅਸੀਂ ਆਪਣੇ ਆਪਣੇ ਹੋਸਪੀਟਲਾਂ ਵਿੱਚ ਜਾ ਕੇ ਇਲਾਜ ਕਰਵਾ ਲੈਂਦੇ ਹਨ